ਪੰਜਾਬ ਦਾ ਸੱਭਿਆਚਾਰ ਪੁਰਾਣੇ ਸਮੇਂ ਤੋਂ ਹੀ ਆਪਣੇ ਆਪ 'ਚ ਇੱਕ ਵੱਖਰੀ ਪਹਿਚਾਣ ਰਿਹਾ ਹੈ ਅਤੇ ਪੰਜਾਬ ਦੇ ਸੱਭਿਆਚਾਰ ਨੇ ਸਦਾ ਹੀ ਭਾਈਚਾਰੇ ਅਤੇ ਮਿਲਵਰਤਨ ਨਾ ਪ੍ਰਤੀਕ ਦਿੱਤਾ ਹੈ ਪੰਜਾਬ 'ਚ ਜਿੰਨੇ ਵੀ ਗੁਰੂ ਪੀਰ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਹੀ ਇਹ ਪੰਜਾਬੀ ਸੱਭਿਆਚਾਰ ਜੀਵਨ ਬਤੀਤ ਕੀਤਾ ਹੈ ਅਤੇ ਪੰਜਾਬੀ ਸੱਭਿਆਚਾਰ ਇੱਕ ਇਹੋ ਜਿਹੀ ਚੀਜ਼ ਹੋ ਗਈ ਹੈ ਕਿ ਜਿਹੜੀ ਕਿ ਪੰਜਾਬ ਤਾਂ ਪੰਜਾਬ ਇਹ ਵਿਦੇਸ਼ਾਂ ਵਿੱਚ ਵੀ ਬਹੁਤ ਹੀ ਮਤਲਬ ਵੱਡੇ ਪੱਧਰ 'ਤੇ ਫੈਲ ਰਹੀ ਹੈ ਅਤੇ ਮੈਨੂੰ ਮਾਣ ਹੁੰਦਾ ਏ ਕਿ ਮੈਂ ਪੰਜਾਬੀ ਸੱਭਿਆਚਾਰ ਨਾਲ ਸੰਬੰਧ ਰੱਖਦਾ